ਹਾਂਜੀ ਅਸੀਂ ਆਪਣੇ ਖੇਤਰ ਵਿੱਚ ਜ਼ਮੀਨ ਖਰੀਦਣ ਦੇ ਵੇਚਣ ਵੇਲੇ ਲੋਕਾਂ ਨੂੰ ਬਹੁਤ ਜਿਹੜੀਆਂ ਹੈ ਨਾ ਜਿਹੜੀਆਂ ਕਾਨੂੰਨੀ ਸਮੱਸਿਆਵਾਂ ਨੇ ਉਹ ਆਉਂਦੀਆਂ ਨੇ ਜਿਵੇਂ ਰਜਿਸਟਰੀਆਂ ਲਗਾ ਲਓ ਫਰਦਾਂ ਲਗਾ ਲਓ ਜਾਂ ਜਿਹੜੀ ਉਹ ਜ਼ਮੀਨ ਆ ਜੋ ਅਸੀਂ ਲੈਨੇ ਹਾਂ ਜਾਂ ਖਰੀਦਦੇ ਹਾਂ ਜਾਂ ਵੇਚਦੇ ਹਾਂ ਵੀ ਉਹ ਲਾਲ ਲਕੀਰ ਦੇ ਅੰਦਰ ਆ ਜਾਂ ਉਹਦੀ ਰਜਿਸਟਰੀ ਹੋਈ ਹੋਈ ਆ ਇਹ ਸਾਰੀਆਂ ਚੀਜ਼ਾਂ ਪਹਿਲਾਂ ਜਿਵੇਂ ਅਸੀਂ ਫਰਦਾਂ ਨੇ ਜਿਹੜੀਆਂ ਉਹਨੂੰ ਕਹਿੰਦੇ ਨੇ ਵੀ ਪਟਵਾਰੀਆਂ ਕੋਲ ਜਾਓ ਜੀ ਕਾਨੂੰਗੋਆਂ ਨੂੰ ਬੁਲਾਓ ਤਾਂ ਇਹਦੀ ਮਤਲਬ ਸਾਰੀ ਇਨਕੁਆਇਰੀ ਕੀਤੀ ਜਾਂਦੀ ਆ ਵੀ ਇਹ ਸਹੀ ਹੈ ਉਹੀ ਬੰਦੇ ਦੀ ਆ ਜਾਂ ਕਿਸੇ ਹੋਰ ਦੀ ਆ ਪਰ ਉਹਨਾਂ ਨੂੰ ਇਨਕੁਆਇਰੀ ਕਰਨ ਦੇ ਲਈ ਲੋਕ ਜਿਹੜੇ ਲੋਕ ਪਟਵਾਰੀ ਜਾਂ ਕਾਨੂੰਗੋ ਵਗੈਰਾ ਨੇ ਉਹ ਪੈਸੇ ਲੋਕਾਂ ਤੋਂ ਵੱਧ ਮੰਗਦੇ ਨੇ ਜਦ ਕਿ ਲੋਕ ਇੰਨੇ ਪੈਸੇ ਨਹੀਂ ਦੇ ਸਕਦੇ ਤਾਂ ਸਾਰੀਆਂ ਬਹੁਤ ਜ਼ਿਆਦਾ ਜਿਵੇਂ ਕਾਨੂੰਨੀ ਨੇ ਉਹ ਪ੍ਰੋਬਲਮਾਂ ਆਉਂਦੀਆਂ ਨੇ ਸਾਡੀ ਲਾਈਫ ਦੇ ਵਿੱਚ